ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਦੁਨੀਆਂ ਵਿੱਚ ਜੋ ਵੀ ਚੱਲ ਰਿਹਾ ਹੈ ਜੋ ਵੀ ਸਾਡੇ ਆਸ ਪਾਸ ਇਸ ਟਾਈਮ 'ਤੇ ਘੱਟ ਰਿਹਾ ਹੈ ਉਸ ਨੂੰ ਦੇਖਦੇ ਹੋਏ ਡਰਾਇੰਗ ਦੇ ਵਿੱਚ ਯਥਾਰਥਵਾਦ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਇਹ ਸਿਰਫ ਡਰਾਇੰਗ ਸਿਰਫ ਇੱਕ ਟਾਈਮ ਪਾਸ ਦਾ ਜਰੀਆ ਨਹੀਂ ਹੈ ਇਸ ਨੂੰ ਦੇਖਦੇ ਹੋਏ ਤੁਸੀਂ ਜਾਂ ਇਸ ਦੇ ਦੁਆਰਾ ਤੁਸੀਂ ਦੁਨੀਆਂ ਪੂਰੀ ਦੁਨੀਆਂ ਦੇ ਵਿੱਚ ਇੱਕ ਸੰਦੇਸ਼ ਭਿਜਵਾ ਸਕਦੇ ਹੋ ਯਥਾਰਥਵਾਦ ਦੇਖਿਆ ਜਾਵੇ ਡਰਾਇੰਗ ਦੇ ਵਿੱਚ ਤਾਂ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਇਸ ਦੇ ਵਿੱਚ ਰੰਗ ਭਰਦੇ ਹਾਂ ਜਿਸ ਤਰ੍ਹਾਂ ਦੀ ਆਪਾਂ ਚਿੱਤਰਕਾਰੀ ਕਰਦੇ ਹਾਂ ਉਹ ਸਾਰਾ ਹੀ ਇੱਕ ਸਮਾਨ ਹੈ ਜੇ ਆਪਾਂ ਭਾਵਨਾਵਾਂ ਦੀ ਗੱਲ ਕਰੀਏ ਤਾਂ ਡਰਾਇੰਗ ਬਣਾਉਣ ਦੇ ਟਾਈਮ 'ਤੇ ਆਪਣਾ ਮੂਡ ਜਿਸ ਤਰ੍ਹਾਂ ਦਾ ਵੀ ਹੁੰਦਾ ਹੈ ਆਪਣੇ ਦਿਲ ਦੇ ਅੰਦਰ ਜੋ ਖੁਸ਼ੀ ਆਪਾਂ ਮਹਿਸੂਸ ਕਰਦੇ ਹਾਂ ਜਾਂ ਕਿਸੇ ਤਰ੍ਹਾਂ ਦਾ ਦੁੱਖ ਹੁੰਦਾ ਹੈ ਜੋ ਵੀ ਭਾਵਨਾਵਾਂ ਦਿਲ ਦੇ ਵਿੱਚੋਂ ਨਿਕਲਦੀ ਹੈ ਜਾਂ ਦਿਮਾਗ ਦੇ ਵਿੱਚੋਂ ਨਿਕਲਦੀ ਹੈ ਉਸ ਨੂੰ ਦੇਖਦੇ ਹੋਏ ਇੱਕ ਡਰੋਇੰਗ ਜਾਂ ਇੱਕ ਖੂਬਸੂਰਤ ਚਿੱਤਰ ਕੋਰੇ ਕਾਗਜ਼ 'ਤੇ ਬਣਾਇਆ ਜਾਂਦਾ ਹੈ ਇਸ ਤੋਂ ਦੇਖ ਕੇ ਸਾਹਮਣੇ ਵਾਲੇ ਨੂੰ ਵੀ ਮਤਲਬ ਕਿ ਪਤਾ ਲੱਗੇ ਬਣਾਉਣ ਵਾਲੇ ਦੇ ਦਿਲ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਉਸ ਟਾਈਮ 'ਤੇ ਕੀ ਚੱਲ ਰਿਹਾ ਹੈ ਔਰ ਜੋ ਚੀਜ਼ ਉਸ ਨੇ ਬਣਾਈ ਹੈ ਉਹ ਉਤਨੀ ਹੀ ਆਸਾਨ ਹੈ ਦੇਖਣ ਦੇ ਵਿੱਚ ਵੀ ਔਰ ਸਮਝਣ ਦੇ ਵਿੱਚ ਵੀ